ਸਾਡੇ ਖੇਤਰ ਵਿੱਚ ਸੈਲਾਨੀਆਂ ਦਾ ਦੌਰ ਬਹੁਤ ਜਿਆਦਾ ਹੈ ਇਸ ਲਈ ਸਾਡੇ ਖੇਤਰ ਦੇ ਲੋਕਾਂ ਨੇ ਪਿੰਡ ਵਿੱਚ ਇੱਕ ਧਰਮਸ਼ਾਲਾ ਬਣਾਈ ਹੈ ਇਸ ਵਿੱਚ ਸੈਲਾਨੀ ਆਪਣਾ ਆਣ ਕੇ ਰਹਿ ਸਕਦੇ ਹਨ ਇਸ ਵਿੱਚ ਵੀਹ ਕਮਰੇ ਅਤੇ ਚਾਰ ਵੱਡੇ ਹਾਲ ਬਣਾਏ ਗਏ ਹਨ ਅਤੇ ਇਸਦੇ ਨਾਲ ਨਾਲ ਉਨ੍ਹਾਂ ਦਾ ਰਹਿਣ ਦਾ ਅਤੇ ਖਾਣ ਪੀਣ ਦੀ ਵਿਵਸਥਾ ਬਿਲਕੁਲ ਮੁਫ਼ਤ ਕੀਤੀ ਗਈ ਹੈ ਇਸਦੇ ਨਾਲ ਨਾਲ ਜੇ ਕੋਈ ਸੈਲਾਨੀ ਨੂੰ ਕੋਈ ਵੀ ਮੈਡੀਕਲ ਸੁਵਿਧਾ ਜਾਂ ਫੇਰ ਹੋਰ ਕੋਈ ਉਹਨੂੰ ਲੋੜੀਂਦਾ ਸਮਾਨ ਚਾਈਦਾ ਹੈ ਤਾਂ ਉਹ ਇਸ ਧਰਮਸ਼ਾਲਾ ਦੇ ਵਿੱਚੋਂ ਬਿਲਕੁਲ ਮੁਫ਼ਤ ਪ੍ਰਾਪਤ ਕਰ ਸਕਦਾ ਹੈ ਅਤੇ ਆਪਣੀ ਲੋੜ ਨੂੰ ਪੂਰਾ ਕਰ ਸਕਦਾ ਹੈ ਇਸ ਦੇ ਨਾਲ ਨਾਲ ਜੇ ਕੋਈ ਆਸ ਪਾਸ ਦੇ ਖੇਤਰ ਦੇ ਵਿੱਚ ਜਾਂ ਫੇਰ ਹੋਰ ਪਿੰਡ ਦੇ ਖੇਤਰ ਦੇ ਵਿੱਚ ਘੁੰਮਣਾ ਚਾਹੁੰਦਾ ਹੈ ਤਾਂ ਉਸਦੇ ਲਈ ਮੁਫ਼ਤ ਆਵਾਜਾਈ ਦੇ ਸਾਧਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤਾਂ ਕੀ ਉਹਨੂੰ ਜਾਣ ਜਾਣ ਲਈ ਕੋਈ ਮੁਸ਼ਕਿਲ ਨਾ ਹੋਵੇ ਉਹ ਆਪਣਾ ਮਾਈਂਡ ਫ੍ਰੀ ਹੋ ਕੇ ਓਥੇ ਘੁੰਮ ਸਕੇ ਉਸ ਤੋਂ ਬਾਦ ਪਿੰਡ ਦੇ ਲੋਕਾਂ ਨੇ ਹੋਰ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਦੇ ਲਈ ਪਿੰਡ ਦੇ ਇੱਕ ਵੱਡੇ ਹਾਲ ਦੇ ਵਿੱਚ ਪੰਜਾਬੀ ਸੱਭਿਆਚਾਰ ਦੇ ਨਾਲ ਸਬੰਧਿਤ ਜਿਹੜੇ ਪੁਰਾਣੇ ਸਮੇਂ ਦੇ ਲੋਕਾਂ ਨਾਲ ਸਬੰਧਿਤ ਬਹੁਤ ਸਾਰੀਆਂ ਚੀਜ਼ਾਂ ਨੂੰ ਪ੍ਰ ਪਰਤੁਤ ਕੀਤਾ ਗਿਆ ਹੈ ਤਾਂ ਜੋ ਸੈਲਾਨੀ ਏਥੇ ਆਣ ਕੇ ਉਨ੍ਹਾਂ ਪੁਰਾਣੇ ਸੱਭਿਆਚਾਰ ਨੂੰ ਪੰਜਾਬੀ ਵਿਰਸੇ ਨੂੰ ਵੇਖ ਸਕਣ ਕੀ ਪਿਛਲੇ ਜਮਾਨੇ ਦੇ ਲੋਕ ਕਿਸ ਤਰ੍ਹਾਂ ਆਪਣਾ ਸਮਾਂ ਬਤੀਤ ਕਰਦੇ ਸਨ ਕਿਉਂਕੀ ਉਸ ਸਮੇਂ ਨਾ ਤਾਂ ਕੋਈ ਟੀਵੀ ਸੀ ਤੇ ਨਾ ਹੀ ਫੋਨ ਸਨ ਉਹ ਲੋਕ ਆਪਣੀ ਦੁਪਹਿਰ ਸ਼ਾਮ ਅਤੇ ਸੁਬਾਹ ਦਾ ਜਿਹੜਾ ਕੰਮ ਸੀ ਉਹ ਕਿਹੜੇ ਕਿਹੜੇ ਕੰਮ ਕਰਕੇ ਬਤੀਤ ਕਰਦੇ ਸਨ